ਸਿੱਕਿਆਂ ਦੀ ਗੱਲ ਕਰੀਏ ਤਾਂ ਮੇਰੇ ਕੋਲ਼ ਕਾਫੀ ਸਿੱਕੇ ਹਨ ਉਹਨਾਂ ਵਿੱਚੋਂ ਇੱਕ ਸਿੱਕਾ ਜੋ ਕਿ ਮੇਰੇ ਭਰਾ ਨੂੰ ਰਾਜਸਥਾਨ ਤੋਂ ਰੇਤ ਵਿੱਚੋਂ ਮਿਲਿਆ ਸੀ ਉਸ ਦੀ ਕੀਮਤ ਬਹੁਤ ਜ਼ਿਆਦਾ ਹੈ ਉਹ ਅੱਜ ਵੀ ਲੱਖਾਂ ਰੁਪਏ ਦਾ ਵਿਕ ਸਕਦਾ ਹੈ ਸਾਨੂੰ ਚਾਹੀਦਾ ਹੈ ਕਿ ਪੁਰਾਣੇ ਸਿੱਕੇ ਹੋਰ ਜ਼ਿਆਦਾ ਇਕੱਠੇ ਕਰੀਏ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਦਈਏ